ਪੰਛੀ ਸਾਡੇ ਵਾਤਾਵਰਨ ਦੇ ਬਹੁਤ ਹੀ ਖਾਸ ਹ ਹੈ ਮੈਂ ਇਹਨਾਂ ਨੂੰ ਬਹੁਤ ਵਾਰ ਮਾਈਗ੍ਰੇਸ਼ਨ ਕਰਦੇ ਹੋਏ ਵੇਖਿਆ ਹੈ ਮੈਨੂੰ ਉਹਨਾਂ ਨੂੰ ਵੇਖ ਕੇ ਬਹੁਤ ਹੀ ਚੰਗਾ ਅਨੁਭਵ ਹੁੰਦਾ ਹੈ ਉਹ ਇੱਕ ਇਹੋ ਜਿਹਾ ਅਨੁਭਵ ਕਰਵਾਉਂਦੇ ਹਨ ਕਿ ਤੁਸੀਂ ਕੁਦਰਤ ਦੇ ਨਾਲ ਜੁੜ ਗਏ ਹੋ ਇਹ ਇੱਕ ਬਹੁਤ ਹੀ ਵਧੀਆ ਚੀਜ਼ ਹੈ ਕਿ ਜੋ ਅੱਜ ਵੀ ਸਾਨੂੰ ਪੰਛੀ ਥੋੜ੍ਹੇ ਥੋੜ੍ਹੇ ਚਾਹੇ ਹੋਣ ਨਜ਼ਰ ਆ ਰਹੇ ਹਨ ਕਿਉਂਕਿ ਅੱਜ ਕੱਲ੍ਹ ਦੀ ਰੇਡੀਏਸ਼ਨ ਦੇ ਕਾਰਨ ਪੰਛੀ ਬਹੁਤ ਜ਼ਿਆਦਾ ਘੱਟ ਗਏ ਹਨ ਅਤੇ ਸਾਨੂੰ ਇਹਨਾਂ ਨੂੰ ਠੀਕ ਕਰਨ ਦੇ ਲਈ ਬਹੁਤ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ ਨਹੀਂ ਤਾਂ ਇਹ ਪੰਛੀ ਸਾਡੇ ਸਮਾਜ ਦੇ ਵਿੱਚੋਂ ਪਰਿਆਵਰਨ ਵਾਤਾਵਰਨ ਦੇ ਵਿੱਚੋਂ ਹੀ ਨਿਕਲ ਜਾਣਗੇ ਸਾਨੂੰ ਇਹਨਾਂ ਦੇ ਲਈ ਕੁਛ ਨਾ ਕੁਛ ਅੱਗੇ ਆ ਕੇ ਸਹੀ ਕੰਮ ਕਰਨੇ ਚਾਹੀਦੇ ਹਨ ਮੈਂ ਉਹਨਾਂ ਨੂੰ ਪੂਰਵ ਦਿਸ਼ਾ ਵਿੱਚ ਜਾਂਦੇ ਹੋਏ ਦੇਖਿਆ ਉਹਨਾਂ ਦੇ ਵਿੱਚ ਕਬੂਤਰ ਕਾਂ ਚਿੜੀ ਹਰ ਤਰ੍ਹਾਂ ਦੇ ਪੰਛੀਆਂ ਨੂੰ ਮੈਂ ਵੇਖਿਆ ਜੋ ਕਿ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਜਾ ਰਹੇ ਸਨ ਉਹ ਬਹੁਤ ਵਧੀਆ ਝੁੰਡ ਬਣਾ ਕੇ ਇੱਕ ਦੂਜੇ ਦੇ ਨਾਲ ਇਕੱਠੇ ਹੋ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਜਾ ਰਹੇ ਸਨ ਜੋ ਕਿ ਬਹੁਤ ਹੀ ਚੰਗਾ ਲੱਗ ਰਿਹਾ ਸੀ ਧੰਨਵਾਦ